ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਲ ਹੈ ਕਿ ਤੁਸੀਂ ਸਕੂਲ ਵਿੱਚ ਪੇਂਟਿੰਗ ਕੀ ਸਿੱਖੀ ਸਕੂਲ ਵਿੱਚ ਸਿੱਖੀ ਪੇਂਟਿੰਗ ਬਾਰੇ ਇੱਕ ਤਜਰਬਾ ਸਾਂਝਾ ਕਰੋ ਮੈਂ ਸਭ ਤੋਂ ਪਹਿਲਾਂ ਆਪਣੇ ਸਕੂਲ ਦੇ ਵਿੱਚ ਆਪਣੇ ਮਾਸਟਰ ਜੀ ਤੋਂ ਜੋ ਪੇਂਟਿੰਗ ਸਿੱਖੀ ਜੋ ਇੱਕ ਘਰ ਬਣਾ ਕੇ ਦਿਖਾਇਆ ਸੀਗਾ ਅਤੇ ਇੱਕ ਘਰ ਦੇ ਨਾਲ ਦਰਖਤ ਸੀ ਜੋ ਕਿ ਬਹੁਤ ਹੀ ਤਜਰਬੇਕਾਰ ਰਿਹਾ ਕਿਉਂਕਿ ਮੈਨੂੰ ਬਹੁਤ ਹੀ ਐ ਲਗਾ ਲਓ ਵੀ ਮੈਨੂੰ ਦੋ ਤਿੰਨ ਦਿਨ ਦਾ ਸਮਾਂ ਲੱਗਿਆ ਉਹਨੂੰ ਬਣਾਉਣ ਲਈ ਆਪਣੇ ਮਾਸਟਰ ਜੀ ਨੂੰ ਖੁਸ਼ ਕਰਨ ਲਈ ਬਹੁਤ ਉਹ ਤਜਰਬਾ ਕਿਉਂਕਿ ਉਹਦੇ ਵਿੱਚ ਇਕੱਲਾ ਇਕੱਲਾ ਪੁਆਇੰਟ ਜਿਵੇਂ ਕਿ ਆਪਣਾ ਦਰਖਤ ਦਰਖਤ ਦੇ ਨਾਲ ਉਹਦੇ ਸੂਰਜ ਇਹਦੇ ਫੋਟੋ ਛਾਪਣੀ ਪੰਛੀਆਂ ਦਾ ਚਹਿਲ ਪਹਿਲ ਬਾਰੇ ਦਰ ਦਰਸਾਉਣਾ ਜਾਂ ਕੁਛ ਆਪਣੇ ਘਰ ਦੇ ਵਿੱਚ ਜਿਵੇਂ ਆਪਾਂ ਘਰ ਹੈ ਘਰ ਵੀ ਇੱਕ ਤਰ੍ਹਾਂ ਦਾ ਆਪਦਾ ਘਰ ਲੱਗਣਾ ਜਾਂ ਕੋਈ ਦਰਸਾਉਣਾ ਮੈਨੂੰ ਬਹੁਤ ਹੀ ਬਹੁਤ ਹੀ ਤਜਰਬੇਕਾਰ ਚੀਜ਼ ਲੱਗੀ ਜੋ ਕਿ ਮੈਨੂੰ ਮੈਂ ਅੱਜ ਵੀ ਉਹਨਾਂ ਮਾਸਟਰ ਜੀ ਦਾ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਉਹ ਪੇਂਟਿੰਗ ਪਹਿਲੀ ਵਾਰ ਦੱਸੀ ਅਤੇ ਉਸ ਤੋਂ ਬਾਅਦ ਮੈਨੂੰ ਕਰਨ ਬਾਰੇ ਉਹਨਾਂ ਨੇ ਦ ਕਿਹਾ